ਹਾਂਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਆਪਦੇ ਰੋਜ਼ਾਨਾ ਜੀਵਨ ਵਿੱਚ ਕੰਪਿਊਟਰ ਦੀ ਕੰਪਿਊਟਰ ਦਾ ਉਪਯੋਗ ਜ਼ਿਆਦਾ ਕਰਦੇ ਹਾਂ ਵਰਤੋਂ ਜ਼ਿਆਦਾ ਕਰਦੇ ਹਾਂ ਕੰਪਿਊਟਰ ਵਿੱਚ ਅਸੀਂ ਅਸੀਂ ਰੋਜ਼ਾਨਾ ਆਪਣਾ ਕੰਮ ਕਰ ਸਕਦੇ ਹਾਂ ਕੰਪਿਊਟਰ ਵਿੱਚ ਅਸੀਂ ਆਪਦੀਆਂ ਫਾਈਲਾਂ ਡਾਕੂਮੈਂਟਸ ਵਗੈਰਾ ਸੇਵ ਕਰ ਰੱਖ ਕਰਦੇ ਹਾਂ ਜੋ ਵੀ ਕੰਮ ਹੁੰਦਾ ਹੈ ਅਸੀਂ ਆਪਦੇ ਕੰਪਿਊਟਰ ਵਿੱਚ ਕਰ ਸਕਦੇ ਹਾਂ ਉਹਦੇ ਵਿੱਚ ਅਸੀਂ ਸੇਫ ਕਰ ਸਕਦੇ ਹਾਂ ਸੇਵ ਕਰ ਲੈਂਦੇ ਹਾਂ ਤਾਂ ਕੰਪਿਊਟਰ ਦੀ ਮਦਦ ਦਾ ਸਾਡੇ ਜੀਵਨ ਵਿੱਚ